ਹੈਲੋ ਹੈਲੋ ਹਾਂਜੀ ਹਾਂਜੀ ਕੌਣ ਹਾਂਜੀ ਹਾਂਜੀ ਬੋਲੋ ਕੀ ਮੰਗਵਾਇਆ ਸੀ ਮੈਡਮ ਤੁਸੀਂ ਸਮਾਨ ਕੀ ਚੀਜ ਨੀ ਤੁਹਾਨੂੰ ਸਹੀ ਲੱਗੀ ਫਿਰ ਅਸੀਂ ਓਹੀਓ ਚੀਜ ਦੀ ਇੰਪਰੂਵਮੈਂਟ ਕਰੀਏ ਕੀ ਚੀਜ ਹਾਂਜੀ ਹਾਂਜੀ ਕੀ ਚੀਜ ਮੰਗੂਆਈ ਸੀ ਮੈਮ ਤੁਸੀਂ ਅੱਛਾ ਕਿਸ ਚੀਜ ਚ ਤੁਹਾਨੂੰ ਦਿੱਕਤ ਆਈ ਐ ਅੱਛਾ ਕੋਈ ਗੱਲ ਨੀ ਮੈਮ ਤੁਸੀਂ ਰਿਫੰਡ ਵਾਲੀ ਓਪਸ਼ਨ ਕਰ ਦਿਆ ਜੇ ਜਾਂ ਤੁਸੀਂ ਰੀਪਲੇ ਸਮ ਕਰ ਕਰਵਾਦਾਂਗੀ ਤੁਹਾਡਾ ਰਿਟਰਨ ਹੋ ਕੇ ਤੁਹਾਨੂੰ ਵਧੀਆ ਮਿਲਜੇਗਾ ਹਾਂਜੀ ਨਈਂ ਹਾਫ ਹਾਫ ਸਮਾਨ ਰਿਟਰਨ ਹੋਜੇਗਾ ਹਾਂਜੀ ਕੋਈ ਗੱਲ ਨੀ ਅਸੀਂ ਅੱਗੇ ਤੋਂ ਐਸ ਚੀਜ ਦਾ ਧਿਆਨ ਦਵਾਂਗੇ ਹਾਂਜੀ ਹਾਂਜੀ ਵੈਸੇ ਤਾਂ ਸਾਡਾ ਸਾਰਾ ਸਮਾਨ ਈ ਵਧੀਆ ਹੁੰਦਾ ਐ ਪਰ ਐਸ ਵਰੀ ਮੌਸਮ ਚੇਂਜ ਹੋ ਰਿਆ ਤਾਂ ਪਤਾ ਕੀ ਹੋਵੇ ਸਲਾਬ ਵਗੈਰਾ ਹਾਂਜੀ ਅੱਗੇ ਤੁਸੀਂ ਲੈਂਦੇ ਈ ਓ ਸਮਾਨ ਤੁਹਾਨੂੰ ਪਤਾ ਈ ਐ ਕੁਆਲਿਟੀ ਵਗੈਰਾ ਤਾਂ ਵਧੀਆ ਈ ਹੁੰਦੀ ਐ ਹਾਂਜੀ ਠੀਕ ਐ ਜੀ ਕੋਈ ਗੱਲ ਨੀ ਜੀ ਠੀਕ ਐ ਓਕੇ